ਹਾਂ ਹੋਰ ਗ੍ਰਹਿਆਂ 'ਤੇ ਜੀਵਨ ਹੈ ਸੰਭਾਵਨਾ ਹੋ ਸਕਦੀਆਂ ਹਨ ਕਈ ਗ੍ਰਹਿ 'ਤੇ ਕਹਿੰਦੇ ਹਨ ਕਿ ਪਾਣੀ ਵੀ ਹੈ ਅਤੇ ਜ਼ਮੀਨ ਵੀ ਹੈ ਉਹਨਾਂ ਗ੍ਰਹਿਆਂ 'ਤੇ ਜੀਵਨ ਬਸਰ ਕੀਤਾ ਜਾ ਸਕਦਾ ਹੈ ਅਜੇ ਕੀਤਾ ਨਹੀਂ ਪਰ ਆਂ ਅਗਾਂਹ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਹੋ ਸਕਦਾ ਹੈ ਸੰਭਵ ਜਿਵੇਂ ਕਿ ਅਮਰੀਕਾ ਜਾਂ ਰੂਸ ਜਾਂ ਹੋਰ ਦੇਸ਼ ਜਿਹੜੇ ਨੇ ਇਸ ਬਾਰੇ ਸੋਚ ਰਹੇ ਹਨ ਉਹਨਾਂ ਨੇ ਇਸ ਸੰਬੰਧੀ ਕਈ ਉਪ ਗ੍ਰਹਿ ਰਾਹੀਂ ਤਸਵੀਰਾਂ ਵੀ ਖਿੱਚੀਆਂ ਹਨ ਅਤੇ ਇਹਨਾਂ ਗ੍ਰਹਿਆਂ ਦੇ ਵਿੱਚ ਪਾਣੀ ਹੈ ਗ੍ਰਹਿਆਂ ਦੇ ਉੱਪਰ ਧਰਤੀ ਹੈ ਖੇਤੀ ਵੀ ਕੀਤੀ ਜਾ ਸਕਦੀ ਹੈ ਸਿੰਚਾਈ ਕੀਤੀ ਜਾ ਸਕਦੀ ਹੈ ਫਸਲ ਉਗਾਈ ਜਾ ਸਕਦੀ ਹੈ ਅਤੇ ਰੈਣ ਬਸੇਰਾ ਵੀ ਕਾਇਮ ਕੀਤਾ ਜਾ ਸਕਦਾ ਹੈ